ਪਾਣੀ ਸਾਡੀ ਜ਼ਿੰਦਗੀ ਦੀ ਅਮੁੱਲ ਲੋੜ ਹੈ ਪਾਣੀ ਤੋਂ ਬਿਨਾ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਪਾਣੀ ਤਾਂ ਪਸ਼ੂ ਪੰਛੀਆਂ ਨੂੰ ਅਤੇ ਜਾਨਵਰਾਂ ਨੂੰ ਅਤੇ ਮਨੁੱਖਾਂ ਨੂੰ ਅਤੇ ਪੇੜ ਪੌਦਿਆਂ ਨੂੰ ਵੀ ਪਾਣੀ ਚਾਹੀਦਾ ਹੈ ਪਾਣੀ ਤੋਂ ਬਿਨਾ ਤਾਂ ਬਿਲਕੁਲ ਰਹਿਣਾ ਮੁਸ਼ਕਲ ਹੈ ਪਾਣੀ ਪਹਿਲਾਂ ਤਾਂ ਬਹੁਤ ਸਾਫ ਸੁਥਰਾ ਮਿਲਦਾ ਹੁੰਦਾ ਸੀ ਪਹਿਲੇ ਲੋਕ ਖੂਹਾਂ 'ਚੋਂ ਨਲਕਿਆਂ 'ਚੋਂ ਪਾਣੀ ਨੂੰ ਇੱਦਾਂ ਹੀ ਪੀ ਲੈਂਦੇ ਸਨ ਅਤੇ ਕੋਈ ਕਿਸੇ ਦੀ ਪਾਣੀ ਦੀ ਪਰਵਾਹ ਨਹੀਂ ਕਰਦਾ ਸੀ ਕਿ ਕਿੱਥੋਂ ਪਾਣੀ ਗੰਦਾ ਹੈ ਕਿ ਸਾਫ ਹੈ ਪਰ ਹੁਣ ਤਾਂ ਹਰ ਪਾਸੇ ਗੰਦਗੀ ਪਲੂਸ਼ਨ ਹਰ ਜਗ੍ਹਾ 'ਤੇ ਗੰਦਾਪਣ ਹੋਣ ਕਰਕੇ ਪਾਣੀ ਨੂੰ ਵੀ ਗੰਦਾ ਕ ਲੋਕ ਕਰ ਰਹੇ ਹਨ ਇਸ ਕਰਕੇ ਪਾਣੀ ਨੂੰ ਫਿਲਟਰ ਕਰਨ ਵਾਸਤੇ ਸਾਨੂੰ ਕਈ ਤਰ੍ਹਾਂ ਦੇ ਕੰਮ ਕਰਨੇ ਚਾਹੀਦੇ ਹਨ ਨੰਬਰ ਇੱਕ 'ਤੇ ਤਾਂ ਪਾਣੀ ਨੂੰ ਸਭ ਤੋਂ ਪਹਿਲਾਂ ਉਬਾਲ ਕੇ ਪੀਤਾ ਜਾ ਸਕਦਾ ਹੈ ਪਾਣੀ ਉਬਾਲਣ ਦੇ ਨਾਲ ਉਹਦੇ ਜਿਹੜੇ ਵਿੱਚ ਕੀਟਾਣੂ ਹੋਣਗੇ ਉਹ ਮਰ ਜਾਣਗੇ ਇਸ ਕਰਕੇ ਉਸ ਪਾਣੀ ਨੂੰ ਬਾਅਦ 'ਚ ਪੀਤਾ ਜਾ ਸਕਦਾ ਹੈ ਨੰਬਰ ਦੋ 'ਤੇ ਪਾਣੀ ਨੂੰ ਫਿਲਟਰ ਅੱਜ ਤਰ੍ਹਾਂ ਅੱਜ ਕੱਲ੍ਹ ਤਾਂ ਫਿਲਟਰ ਕਈ ਤਰ੍ਹਾਂ ਦੇ ਘਰਾਂ ਵਿੱਚ ਲੱਗ ਗਏ ਹਨ ਫਿਲਟਰ ਕਰਕੇ ਪਾਣੀ ਨੂੰ ਪੀਤਾ ਜਾ ਸਕਦਾ ਹੈ ਫਿਲਟਰ ਪਾਣੀ ਹੁੰਦਾ ਤਾਂ ਸਿਹਤ ਵਾਸਤੇ ਅੱ ਠੀਕ ਨਹੀਂ ਹੈ ਪਰ ਫਿਰ ਵੀ ਇਹ ਕੁਛ ਹੱਦ ਤੱਕ ਪਾਣੀ ਸਾਫ ਹੁੰਦਾ ਜਿਸ ਕਰਕੇ ਅਸੀਂ ਇਸਨੂੰ ਪੀ ਸਕਦੇ ਹਾਂ ਨੰਬਰ ਤਿੰਨ 'ਤੇ ਪਾਣੀ ਨੂੰ ਚਿੱਟੇ ਕੱਪੜੇ ਵਿੱਚ ਕੱਪੜ ਛਾਣ ਕਰਕੇ ਵੀ ਪੀਤਾ ਜਾ ਸਕਦਾ ਹੈ ਪਾਣੀ ਵਿੱਚ ਜਿਹੜੇ ਰੋਗਾਣੂ ਹੁੰਦੇ ਹਨ ਉਹ ਮਰ ਜਾਂਦੇ ਹਨ ਨੰਬਰ ਫ ਚਾਰ 'ਤੇ ਪਾਣੀ ਨੂੰ ਘੜੇ ਵਿੱਚ ਪਾ ਕੇ ਉਹਦੇ ਵਿੱਚ ਰਹਿਣ ਕਰਕੇ ਮਿੱਟੀ ਦੇ ਘੜੇ ਵਿੱਚ ਹੋਣ ਕਰਕੇ ਪਾਣੀ ਸਾਫ ਹੋ ਜਾਂਦਾ ਹੈ ਉਸ ਪਾਣੀ ਨੂੰ ਤੁਸੀਂ ਵਰਤੋਂ ਵਿੱਚ ਲਿਆ ਸਕਦੇ ਹੋ ਅੱਜ ਕੱਲ੍ਹ ਤਾਂ ਪਾਣੀ ਨੂੰ ਅਕਲਾਈਨ ਵੀ ਕੀਤਾ ਜਾ ਸਕਦਾ ਹੈ ਜਿਵੇਂ ਜੇ ਜਿਹੜਾ ਤੁਸੀਂ ਪਾਣੀ ਪੀਣਾ ਹੈ ਉਹਦੇ ਵਿੱਚ ਤੁਸੀਂ ਖੀਰਾ ਕੱਕੜੀ ਕੁਛ ਪੁਦੀਨਾ ਵਗੈਰਾ ਇਹ ਚੀਜ਼ਾਂ ਪਾ ਕੇ ਪਾਣੀ ਨੂੰ ਤੁਸੀਂ ਫਿਲਟਰ ਕਰ ਸਕਦੇ ਹੋ ਤਾਂ ਜੋ ਤੁਹਾਡੇ ਉਹ ਯੋਗ ਪਾਣੀ ਬਣ ਜਾਵੇ ਇਸ ਤਰ੍ਹਾਂ ਅਸੀਂ ਪਾਣੀ ਨੂੰ ਕਈ ਤਰੀਕਿਆਂ ਨਾਲ ਪੀ ਸਕਦੇ ਹਾਂ